ਪੰਜਾਬੀ ਦੇ ਲੋਕ ਗੀਤਾਂ ਬਾਰੇ ਜੇਕਰ ਦੱਸਿਆ ਜਾਵੇ ਤਾਂ ਪੰਜਾਬੀ ਦੇ ਲੋਕ ਗੀਤ ਹੁੰਦੇ ਨੇ ਜਿਹੜੇ ਉਹ ਬਹੁਤ ਹੀ ਵਧੀਆ ਅਤੇ ਬ ਦੁਨੀਆਂ ਚ ਬਹੁਤ ਜ਼ਿਆਦਾ ਮਸ਼ਹੂਰ ਨੇ ਅੱਜ ਕੱਲ੍ਹ ਕਿਉਂਕਿ ਪੰਜਾਬੀ ਸੱਭਿਆਚਾਰ ਹੀ ਬਹੁਤ ਵਧੀਆ ਏ ਅਤੇ ਇਹ ਆਪਣੇ ਸਾਰਿਆਂ ਨੂੰ ਰਲ਼ ਮਿਲ਼ ਕੇ ਇਕੱਠੇ ਰਹਿਣ ਦਾ ਇੱਕ ਉਹ ਦਿੰਦਾ ਏ ਅਤੇ ਜੇਕਰ ਗੱਲ ਕੀਤੀ ਜਾਵੇ ਲੋਕ ਗੀਤਾਂ ਦੀ ਤਾਂ ਇਹਦੇ 'ਚ ਆ ਜਾਂਦੀਆ ਨੇ ਸੁਹਾਗ ਘੋੜੀਆਂ ਲੰਮੀਆਂ ਬੋਲੀਆਂ ਗਿੱਧੇ 'ਚ ਜਿਹੜੀਆ ਬੋਲੀਆਂ ਪਾਈਆਂ ਜਾਂਦੀਆਂ ਨੇ ਉਹ ਭੰਗੜੇ 'ਚ ਬੋਲੀਆਂ ਪਾਈਆਂ ਜਾਂਦੀਆਂ ਨੇ ਅਲੱਗ ਅਲੱਗ ਤਰ੍ਹਾਂ ਦੇ ਲੋਕ ਗੀਤ ਹੁੰਦੇ ਨੇ ਅਤੇ ਇਸ ਬਾਰੇ ਜੇਕਰ ਜਾਣਕਾਰੀ ਦਿੱਤੀ ਜਾਵੇ ਤਾਂ ਗਿੱਧੇ ਦੀਆਂ ਬਹੁਤ ਜ਼ਿਆਦਾ ਬੋਲੀਆਂ ਹੁੰਦੀਆਂ ਨੇ ਜਿੱਦਾਂ ਕੇ ਕਦੇ ਹੂੰ ਕਰਕੇ ਕਦੇ ਹਾਂ ਕਰਕੇ ਗੇੜਾ ਦੇਦੇ ਨੀ ਮੁਟਿਆਰੇ ਲੰਬੀ ਬਾਂਹ ਕਰਕੇ ਅਤੇ ਹੋਰ ਵੀ ਬਹੁਤ ਜ਼ਿਆਦਾ ਤਰ੍ਹਾਂ ਦੀਆਂ ਬੋਲੀਆਂ ਹੁੰਦੀਆਂ ਨੇ